ਬੀਤੇ ਹੋਏ ਸਮੇਂ ਅਤੇ ਯਾਦਾਂ ਨੂੰ ਸਾਂਭਣ ਲਈ ਫੋਟੋਗ੍ਰਾਫੀ ਬਹੁਤ ਹੀ ਮਹੱਤਵਪੂਰਨ ਹੈ ਜਿੱਦਾਂ ਕਿ ਕੋਈ ਵੀ ਪ੍ਰੋਗਰਾਮ ਹੋਵੇ ਯਾ ਅਸੀਂ ਕਿਤੇ ਵੀ ਘੁੰਮਣ ਜਾਂਦੇ ਹਾਂ ਤਾਂ ਮੈਨੂੰ ਫੋਟੋਆਂ ਖਿੱਚ ਕੇ ਰੱਖਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਕਿਉਂਕਿ ਸਮਾਂ ਤਾਂ ਬੀਤ ਜਾਂਦਾ ਹੈ ਪਰ ਅਸੀਂ ਫੋਟੋਗ੍ਰਾਫੀ ਨਾਲ਼ ਯਾਦਾਂ ਨੂੰ ਕੈਦ ਕਰਕੇ ਰੱਖ ਸਕਦੇ ਹਾਂ ਮੈਂ ਸ਼ੁਰੂ ਤੋਂ ਕਿਤੇ ਵੀ ਘੁੰਮਣ ਜਾਂਦੀ ਹਾਂ ਯਾ ਸਾਡੇ ਘਰ ਵਿੱਚ ਕੋਈ ਵੀ ਫੰਕਸ਼ਨ ਹੁੰਦਾ ਹੈ ਤਾਂ ਮੈਂ ਫੋਟੋਗ੍ਰਾਫੀ ਦੁਆਰਾ ਹਰੇਕ ਮੂਮੈਂਟ ਨੂੰ ਕੈਦ ਕਰਕੇ ਰੱਖ ਲੈਂਦੀ ਹਾਂ ਅਤੇ ਜਦੋਂ ਦਿਲ ਕਰਦਾ ਹੈ ਉਨਾਂ ਨੂੰ ਦੇਖ ਲੈਂਦੀ ਹਾਂ ਇਸ ਲਈ ਮੈਨੂੰ ਫੋਟੋਗ੍ਰਾਫੀ ਦਾ ਸ਼ੌਂਕ ਬਹੁਤ ਹੀ ਜ਼ਿਆਦਾ ਹੈ ਤਾਂ ਕਿ ਮੈਂ ਹਰ ਇੱਕ ਪਲ ਨੂੰ ਕੈਦ ਕਰਕੇ ਰੱਖ ਸਕਾਂ